ਹੈਲੋ ਹਾਂਜੀ ਸਰ ਹਾਂਜੀ ਨਮਸਤੇ ਜੀ ਮੈਂ ਮੈਂ ਨਵੀਂ ਨਵੀਂ ਆਈ ਹਾਂ ਇੱਥੇ ਦੋ ਕੁ ਮਹੀਨੇ ਹੋ ਗਏ ਮੈਨੂੰ ਆਈ ਨੂੰ ਅਤੇ ਮੈਂ ਆਪਣੇ ਬੱਚੇ ਦੀ ਐਡਮਿਸ਼ਨ ਕਰਵਾਉਣੀ ਸਕੂਲ 'ਚ ਮੈਨੂੰ ਪਤਾ ਨਹੀਂ ਕਿਹੜੇ ਸਕੂਲ ਸਹੀ ਰਹੇਗਾ ਤੁਸੀਂ ਦੱਸ ਸਕਦੇ ਹੋ ਹਾਂਜੀ ਬੱਚਾ ਜੀ ਤਿੰਨ ਤਿੰਨ ਕੁ ਸਾਲ ਦਾ ਹਾਂਜੀ ਤਿੰਨ ਸਾਲ ਦਾ ਅੱਛਾ ਅੱਛਾ ਜੀ ਅੱਛਾ ਜੀ ਅੱਛਾ ਅੱਛਾ ਜੀ ਅੱਛਾ ਜੀ ਹਾਂਜੀ ਅੱਛਾ ਜੀ ਅੱਛਾ ਜੀ ਹਾਂਜੀ ਇੱਕ ਸ਼ਾਇਦ ਹੈਗਾ ਨੋ ਨੋਰਥ ਇੰਟਰਨੈਸ਼ਨਲ ਜਿਹੜਾ ਸਕੂਲ ਆ ਉਹਦੇ ਬਾਰੇ ਗੱਲ ਕਰ ਰਹੇ ਤੁਸੀਂ ਅੱਛਾ ਜੀ ਅੱਛਾ ਅੱਛਾ ਜੀ ਨਹੀਂ ਪਰ ਸਰਕਾਰੀ ਸਕੂਲ ਵੀ ਸਰਕਾਰੀ ਸਕੂਲ ਵੀ ਵਧੀਆ ਸ਼ਾਇਦ ਸਰਕਾਰੀ ਸਕੂਲ ਵੀ ਵਧੀਆ ਵਾ ਉਹ ਵੀ ਫਸੀਲਟੀਜ ਬਹੁਤ ਹੁੰਦੀਆਂ ਉੱਥੇ ਤਾਂ ਉਨ੍ਹਾਂ ਦੇ ਕੀ ਹਦਾਇਤ ਹੈ ਕਿ ਹਾਂਜੀ

ਅੱਛਾ ਅੱਛਾ ਜੀ ਅੱਛਾ ਅੱਛਾ ਜੀ ਤੁਸੀਂ ਆਪਣੇ ਬੱਚੇ ਨੂੰ ਸਟਾਰਟਿੰਗ ਤੋਂ ਲਗਾਇਆ ਜਾਂ ਫਿਫਥ ਕੈ ਫਿਫਥ ਅੱਛਾ ਜੀ ਠੀਕ ਆ ਅੱਛਾ ਜੀ ਅਤੇ ਵੈਸੇ ਤਾਂ ਪ੍ਰਾਈਵੇਟ ਸਕੂਲ ਵੀ ਵਧੀਆ ਵੈਸੇ ਪੜ੍ਹਾਈ ਵੀ ਵਧੀਆ ਮਿਡ ਡੇ ਮੀਲ ਵੀ ਉੱਥੇ ਮਿਲਦਾ ਅਤੇ ਯੂਨੀਫੋਮ ਵੀ ਮਿਲਦੀ ਸਟੱਡੀ ਵੀ ਵਧੀਆ ਹੁੰਦੀ ਪੜ੍ਹਾਈ ਵੀ ਉੱਥੇ ਵਧੀਆ ਹੁੰਦੀ ਟੀਚਰ ਵੀ ਵਧੀਆ ਹੁੰਦੇ ਆ ਵਧੀਆ ਐਜੂਕੇਸ਼ਨ ਮਿਲਦੀ ਹੁੰਦੀ ਆ ਹਾਂਜੀ ਹਾਂਜੀ ਅੱਛਾ ਜੀ ਜੀ ਅਸੀਂ ਖੁਦ ਖੁਦ ਅਸੀਂ ਛੱਡ ਕੇ ਆ ਜਈਏ ਤਾਂ ਫ਼ਿਰ ਫੀਸ ਘੱਟ ਲੱਗੂਗੀ ਨਾ ਅੱਛਾ ਜੀ

ਅੱਛਾ ਜੀ ਅੱਛਾ ਜੀ ਅੱਛਾ ਅੱਛਾ ਜੀ ਉਹ ਪਲਸ ਟੂ ਤੱਕ ਆ ਨਾ ਪ੍ਰੀ ਨਰਸਰੀ ਤੋਂ ਜਾਂ ਨਰਸਰੀ ਤੋਂ ਸਟਾਰਟਿੰਗ ਆ ਉਹ ਅੱਛਾ ਅੱਛਾ ਜੀ ਠੀਕ ਬਾਕੀ ਹਾਂਜੀ ਅੱਛ ਅੱਛਾ ਜੀ ਠੀਕ ਹਾਂਜੀ ਅੱਛਾ ਠੀਕ ਹੈ ਜੀ ਥੈਂਕ ਯੂ ਸਰ ਓਕੇ ਜੀ